ਅਖ਼ਬਾਰ ਦੇ ਵਿੱਚ ਮੈਂ ਜ਼ਿਆਦਾਤਰ ਤਾਂ ਖ਼ਬਰਾਂ ਹੀ ਪੜ੍ਹਦਾ ਹਾਂ ਅਤੇ ਕਦੇ ਕਦੇ ਪਹੇਲੀਆਂ ਅਤੇ ਕੋਮਿਕਸ ਵੀ ਪਸੰਦ ਕਰ ਲੈਂਦਾ ਪਰ ਮੁੱਖ ਰੂਪ ਵਿੱਚ ਮੈਂ ਅਖ਼ਬਾਰ ਦੇ ਵਿੱਚ ਖ਼ਬਰਾਂ ਪੜ੍ਹਨ ਨੂੰ ਜ਼ਿਆਦਾ ਅਹਿਮੀਅਤ ਦਿੰਦਾ ਹਾਂ ਔਰ ਪੇਪਰ ਪੜ੍ਹਨ ਦਾ ਮੇਰਾ ਜੋ ਰੁਟੀਨ ਹੈ ਉਹ ਹੈ ਕਿ ਸਭ ਤੋਂ ਪਹਿਲਾਂ ਪਹਿਲੇ ਪੰਨੇ 'ਤੇ ਜੋ ਮੁੱਖ ਮੁੱਖ ਖ਼ਬਰਾਂ ਹਨ ਮੈਂ ਉਹਨਾਂ ਨੂੰ ਪੜ੍ਹਦਾ ਹਾਂ ਉਸ ਤੋਂ ਬਾਅਦ ਮੈਂ ਆਖ਼ਰੀ ਪੰਨੇ 'ਤੇ ਜੋ ਖੇਲ ਕੂਦ ਵਾਸਤੇ ਜੋ ਖ਼ਬਰਾਂ ਹੁੰਦੀਆਂ ਹਨ ਖੇਲ ਖੂਦ ਨਾਲ ਸੰਬੰਧਤ ਉਹਨਾਂ ਨੂੰ ਵੀ ਪੜ੍ਹਦਾ ਹਾਂ ਉਸ ਤੋਂ ਬਾਅਦ ਮੈਂ ਸੰਪਾਦਕੀ ਨੂੰ ਪੜ੍ਹਦਾ ਹਾਂ ਉਹ ਦੇਸ਼ ਦੁਨੀਆ ਦੀ ਖ਼ਬਰਾਂ ਦੇ ਬਾਰੇ ਸਾਰਾ ਜਾਇਜ਼ਾ ਲੈਂਦਾ ਹਾਂ ਪਰ ਪੇਪਰ ਪੜ੍ਹਣ ਦਾ ਮੇਰਾ ਰੂਟੀਨ ਜੋ ਹੈ ਉਹ ਰੋਜ਼ਾਨਾ ਹੈ ਮੈਂ ਇੱਕ ਪੇਪਰ ਪਰਮਾਨੈਂਟ ਰੋਜ਼ ਦਾ ਲਗਾਇਆ ਹੋਇਆ ਹੈ ਅਤੇ ਉਸ ਪੇਪਰ ਨੂੰ ਮੈਂ ਰੋਜ਼ਾਨਾ ਹੀ ਪੜ੍ਹਦਾ ਹਾਂ